ਯੋਗ ਨੂੰ ਦੋ ਹਾਲਾਤਾਂ ਵਿੱਚ ਕੀਤਾ ਜਾਂਦਾ ਇੱਕ ਤਾਂ ਆਮ ਜਿਹੜਾ ਏਜ ਬੰਦਾ ਹੋਵੇ ਜਾਂ ਫਿਰ ਹਾਰਟ ਪਿਡਸ ਨਾ ਕਰ ਸਕਦਾ ਹੋਵੇ ਹਾਰਡ ਐਕਸਰਸਾਈਜ਼ ਨਾ ਕਰ ਸਕਦਾ ਹੋਵੇ

ਯੋਗ ਕਰਨ ਨਾਲ ਸਰੀਰ ਨੂੰ ਬਹੁਤ ਹੀ ਬਹੁਤ ਵੱਡਾ ਫ਼ਾਇਦਾ ਹੁੰਦਾ ਜਿਹਦੇ ਨਾਲ ਮਾਨਸਿਕ ਸਥਿਤੀ ਤੁਹਾਡੀ ਸਿਹਤ ਤੁਹਾਡਾ ਸਾਧਾਰਨ ਵਿਵਹਾਰ ਬਹੁਤ ਵਧੀਆ ਰਹਿੰਦਾ ਔਰ ਤੁਸੀਂ ਫਾਲਤੂ ਦੀ ਪਰੇਸ਼ਾਨੀ ਜਿਵੇਂ ਕਿ ਫਿਟ ਨਾ ਹੋਣ ਕਰਕੇ ਦਵਾਈ ਦਾ ਸੇਵਨ ਕਰਨੇ ਕਰ ਰਹੇ ਹਾਂ ਹੋਸਪਿਟਲ ਜਾਂਦੇ ਹਾਂ ਥੋੜ੍ਹਾ ਸੁਭਾਅ ਚਿੜਚਿੜਾ ਹੋਣ ਤੋਂ ਬਚਦਾ ਯੋਗ ਕੁੱਲ ਮਿਲਾ ਕੇ ਬਹੁਤ ਹੀ ਲਾਭਵੰਦ ਚੀਜ਼ ਹੈ ਇਹ ਮੇਰਾ ਸੁਝਾਅ ਇਹ ਆ ਕਿ ਹਰੇਕ ਬੰਦੇ ਨੂੰ ਭਾਵੇਂ ਉਹ ਦਫ਼ਤਰ 'ਚ ਬੈਠਾ ਜੇ ਫੁਰਸਤ ਮਿਲਦੀ ਦਫ਼ਤਰ 'ਚ ਕਰੇ ਘਰ ਵਿੱਚ ਇਕੱਲੇ ਹੋ ਕੇ ਮਿਲੇ ਮਿਲ ਟਾਇਮ ਮਿਲਦਾ ਉੱਥੇ ਕਰੇ ਜੇ ਗਰਾਊਂਡ 'ਚ ਮਿਲਦਾ ਉੱਥੇ ਕਰੇ ਜੇ ਬੰਦਾ ਬਿਲਕੁਲ ਲਾਈਫ 'ਚ ਬਿਜ਼ੀ ਰਹਿੰਦਾ ਤਾਂ ਵੀ ਉਹ ਟਾਈਮ ਕੱਢੇ ਆਪਣੇ ਆਪ ਨੂੰ ਸ਼ਾਂਤ ਕਰ ਲਵੇ ਇਕਾਂਤ ਵਿੱਚ ਇਕਾਂਤ ਵਿੱਚ ਕਰੋ ਕਰਨਾ ਪਵੇਗਾ ਕਰ ਲੈਣਾ ਚਾਹੀਦਾ ਉਸ ਬੰਦੇ ਨੂੰ ਜ਼ਿੰਦਗੀ 'ਚ ਉਸ ਬੰਦੇ ਨੂੰ ਬਹੁਤ ਵੱਡੀ ਸ਼ਾਂਤੀ ਮਿਲੇਗੀ ਚੰਗੀ ਸਿਹਤ ਮਿਲੇਗੀ ਔਰ ਆਲੇ ਦੁਆਲੇ ਦਾ ਵਾਤਾਵਰਨ ਵੀ ਉਹਦੇ ਵਿਵਹਾਰ ਨਾਲ ਉਹਦੇ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਵੀ ਜਿਹੜਾ ਆਪਣੇ ਵਿਵਹਾਰ ਨਾਲ ਬਹੁਤ ਹੀ ਵਧੀਆ ਰਹੂੰਗਾ ਯੋਗ ਸਿਰਫ਼ ਸਰੀਰਕ ਲਾਭਾਂ ਬਾਰੇ ਸੋਚਦਾ ਸੀ ਜਿਵੇਂ ਕਿ ਲਚਕਤਾ ਅਤੇ ਤਾਕਤ ਵਧਾਉਣਾ ਪਰ ਹੌਲੀ ਹੌਲੀ ਇਹ ਮਨ 'ਤੇ ਵੀ ਇਸਦਾ ਬਹੁਤ ਚੰਗਾ ਅਸਰ ਪੈਂਦਾ ਫਿਰ ਮੈਂ ਰਿਪੀਟ ਕਰਦਾ ਇਹ ਗੱਲ ਇਹਦਾ ਆਹਿਸਤਾ ਆਹਿਸਤਾ ਮਨ 'ਤੇ ਵੀ ਬਹੁਤ ਵਧੀਆ ਅਸਰ ਪੈਂਦਾ ਯੋਗ ਕਰਨ ਤੋਂ ਬਾਅਦ ਮਨ ਨੂੰ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ ਤਣਾਅ ਘੱਟਦਾ ਹੈ ਅਤੇ ਬਹੁਤ ਆਰਾਮਦਾਇਕ ਮਹਿਸੂਸ ਕੀਤਾ ਜਾਂਦਾ ਹੈ ਮੇਰੇ ਵਿਚਾਰ ਵਿੱਚ ਮੈਂ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਸਮਝ ਪਾਉਂਦਾ ਹਾਂ ਮੇਰੇ ਅੰਦਰ ਸਕਾਰਾਤਮਕ ਭਾਵਨਾਵਾਂ ਪੈਦਾ ਹੁੰਦੀਆਂ ਹਨ ਅਤੇ ਜ਼ਿਆਦਾ ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰਦਾ ਹਾਂ ਸਰੀਰਿਕ ਤੌਰ 'ਤੇ ਵੀ ਮੈਂ ਬਹੁਤ ਤਬਦੀਲੀ ਦੇਖੀ ਹੈ ਮੇਰੀ ਤਾਕਤ ਅਤੇ ਸਹਿਣਸ਼ੀਲਤਾ ਵਧੀ ਹੈ